ਮੈਂ ਸੌ ਪੰਨੇ ਦੀ ਕਿਤਾਬ ਇੱਕ ਘੰਟੇ ਦੇ ਵਿੱਚ ਪੜ੍ਹ ਲੈਂਦੀ ਹਾਂ ਅਤੇ ਮੈਂ ਲਗਾਤਾਰਤਾ ਦੇ ਵਿੱਚ ਚਾਰ ਘੰਟੇ ਜਿਹੜੀ ਸੀਟਿੰਗ ਪੜ੍ਹਨ ਨੂੰ ਦੇ ਦਿੰਦੀ ਹਾਂ ਜਾਂ ਦੇ ਸਕਦੀ ਹਾਂ ਮੇਰੇ ਕੋਲ ਹਫ਼ਤਾਵਰੀ ਟੀਚੇ ਨੇ ਕਿ ਹਫ਼ਤੇ ਦੇ ਵਿੱਚ ਮੈਂ ਤਿੰਨ ਸੌ ਪੰਨੇ ਪੜ੍ਹਨੇ ਹੁੰਦੇ ਨੇ ਜਾਂ ਫਿਰ ਮੈਨੂੰ ਇਸ ਤੋਂ ਵੱਧ ਵੀ ਜੇ ਪੜ੍ਹਨੇ ਪੈ ਜਾਣ ਤਾਂ ਮੈਂ ਪਰਵਾਹ ਦੇ ਨਾਲ ਪੜ੍ਹ ਸਕਦੀ ਹਾਂ